ਅੱਜ ਦੇ ਸਮਾਜ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਇੱਦਾਂ ਦੀਆਂ ਹਨ ਜਿੱਥੇ ਖਾਣਾ ਪਕਾਉਣ ਦੀ ਸਿਖਲਾਈ ਦਿੱਤੀ ਜਾਂਦੀ ਹਨ ਚਾਹੇ ਉਹ ਸਕੂਲ ਦੀ ਗੱਲ ਕੀਤੀ ਜਾਏ ਚਾਹੇ ਇੰਸਟੀਚਿਊਟਾਂ ਦੀ ਗੱਲ ਕੀਤੀ ਜਾਵੇ ਬਹੁਤ ਸਾਰੇ ਲੋਕ ਪੇਸ਼ੇ ਦੇ ਤੌਰ 'ਤੇ ਸਿਖਲਾਈ ਲੈ ਰਹੇ ਹਨ ਅਤੇ ਖਾਣਾ ਪਕਾਉਣ ਦੀਆਂ ਤਕਨੀਕਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰ ਰਹੇ ਹਨ ਅਜੋਕੀ ਪੀੜ੍ਹੀ ਵੱਧ ਤੋਂ ਵੱਧ ਬਾਹਰ ਦੇ ਮੁਲਕਾਂ ਨੂੰ ਤਰਜੀਹ ਦੇ ਰਹੀ ਹੈ ਜਿੱਥੇ ਜਾ ਕੇ ਬੱਚੇ ਚੰਗੇ ਤੋਂ ਚੰਗੇ ਸ਼ੈੱਫ ਬਣਦੇ ਹਨ ਅਸੀਂ ਟੀ ਵੀ ਵਿੱਚ ਵੀ ਦੇਖਦੇ ਹਾਂ ਕਿ ਬਹੁਤ ਸਾਰੇ ਅਦਾਕਾਰ ਇੱਦਾਂ ਦੇ ਹਨ ਜਿਹੜੇ ਟੀ ਵੀ ਵਿੱਚ ਚੱਲ ਰਹੇ ਪ੍ਰਤੀਯੋਗਿਤਾਵਾਂ ਵਿੱਚ ਭਾਗ ਲੈਂਦੇ ਹਨ ਅਤੇ ਮਾਸਟਰ ਸ਼ੈੱਫ ਬਣ ਕੇ ਇੱਕ ਆਪਣਾ ਮੁਕਾਮ ਹਾਸਿਲ ਕਰਦੇ ਹਨ ਉਹਨਾਂ ਦਾ ਨਾਮ ਵੀ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਕੁਝ ਇਸ ਤਰ੍ਹਾਂ ਦਾ ਕਿੱਤਾ ਵੀ ਪ੍ਰਾਪਤ ਹੋ ਜਾਂਦਾ ਹੈ ਜਿਹਦੇ ਤੋਂ ਉਹ ਆਪਣਾ ਆਉਣ ਵਾਲਾ ਸਮਾਂ ਵੀ ਵਧੀਆ ਕੱਢ ਲੰਘਾ ਸਕਦੇ ਹਨ ਅਤੇ ਕੁਛ ਪੈਸੇ ਵੀ ਕਮਾ ਸਕਦੇ ਹਨ ਅਜਿਹੇ ਬਹੁਤ ਸਾਰੇ ਅਦਾਰੇ ਹਨ ਜਿਨ੍ਹਾਂ 'ਤੇ ਖਾਣਾ ਬਣਾਉਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਮੈਂ ਵੀ ਕੁਛ ਅਜਿਹੀ ਸਕੂਲਾਂ ਵਿੱਚ ਗਈ ਜਿੱਥੇ ਜਾ ਕੇ ਮੈਂ ਦੇਖਿਆ ਕਿ ਉੱਥੇ ਬਹੁਤ ਸਾਰੇ ਖਾਣਾ ਬਣਾਉਣ ਦੀਆਂ ਤਕਨੀਕਾਂ ਨੂੰ ਸਮਝਾਇਆ ਗਿਆ ਅੱਜ ਕੱਲ੍ਹ ਭਾਰਤੀ ਖਾਣੇ ਦੇ ਨਾਲ ਨਾਲ ਹੋਰ ਵੀ ਅਜਿਹੀਆਂ ਅੰਤਰਰਾਸ਼ਟਰੀ ਵ ਵਸਤੂਆਂ ਇੱਦਾਂ ਦੀਆਂ ਹਨ ਅਤੇ ਖਾਣੇ ਇੱਦਾਂ ਦੇ ਹਨ ਜਿਨ੍ਹਾਂ ਨੂੰ ਮਨੁੱਖ ਤਰਜੀਹ ਦਿੰਦਾ ਹੈ ਅਤੇ ਉਹਨਾਂ ਨੂੰ ਸਿੱਖਣ ਦੀ ਲੋੜ ਹੈ ਇੱਕ ਭਾਰਤੀ ਖਾ ਭੋਜਨ ਦੇ ਨਾਲ ਨਾਲ ਸਾਨੂੰ ਦੂਸਰੇ ਸਾਊਥ ਦੇ ਖਾਣੇ ਜਾਂ ਫਿਰ ਅੰਤਰਰਾਸ਼ਟਰੀ ਖਾਣਿਆਂ ਬਾਰੇ ਵੀ ਜਾਣਕਾਰੀ ਮਿਲਦੀ ਹੈ ਅਤੇ ਅਸੀਂ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਬਹੁਤ ਸਾਰਾ ਪੈਸਾ ਕਮਾ ਸਕਦੇ ਹਨ ਅਤੇ ਵੱਖ ਵੱਖ ਮੁਲਕਾਂ ਵਿੱਚ ਜਾ ਕੇ ਆਪਣੇ ਭਾਰਤੀ ਖਾਣੇ ਦੀ ਵੀ ਚਰਚਾ ਕਰ ਸਕਦੇ ਹਾਂ ਬਹੁਤ ਸਾਰੇ ਲੋਕ ਬਾਰ ਬਾਹਰਲੇ ਮੁਲਕਾਂ ਵਿੱਚ ਅਜਿਹੇ ਲੋਕ ਬੈਠੇ ਹਨ ਜਿਨ੍ਹਾਂ ਨੂੰ ਭਾਰਤੀ ਖਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਹੋ ਜਿਹੀਆਂ ਸਿਖਲਾਵਾਂ ਸਿੱਖਿਆ ਕੇਂਦਰਾਂ ਵਿੱਚ ਜਾ ਕੇ ਅਸੀਂ ਸਕੂਲਾਂ ਵਿੱਚ ਅਜਿਹੀ ਸਿਖਲਾਈ ਪ੍ਰਾਪਤ ਕਰਕੇ ਆਪਣੇ ਖਾਣੇ ਨੂੰ ਅਤੇ ਦੂਸਰੇ ਖਾਣਿਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਅਤੇ ਲੋਕਾਂ ਨੂੰ ਵੀ ਸਮਝਾ ਸਕਦੇ ਹਨ ਕਿ ਹਰ ਖਾਣੇ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਚਾਹੇ ਉਹ ਭਾਰਤੀ ਖਾਣਾ ਹੈ ਚਾਹੇ ਉਹ ਅੰਤਰਰਾਸ਼ਟਰੀ ਹੈ ਚਾਹੇ ਰਾਸ਼ਟਰੀ ਖਾਣਾ ਹੈ ਹਰੇਕ ਖਾਣੇ ਦੀ ਆਪਣੀ ਹੀ ਇੱਕ ਮਹੱਤਤਾ ਹੁੰਦੀ ਹੈ ਅਤੇ ਹਰ ਇੱਕ ਤਰ੍ਹਾਂ ਦਾ ਭੋਜਨ ਅਤੇ ਸਵਾਦ ਦੇ ਅਨੁਸਾਰ ਹੀ ਸਾਨੂੰ ਭੋਜਨ ਨੂੰ ਕਰਨਾ ਖਾਣਾ ਚਾਹੀਦਾ ਹੈ